ਭਾਰਤ ਵਿੱਚ ਡਾਂਸਰਾਂ ਅਤੇ ਬੋਲੀਵੁੱਡ ਦਾ ਕਿੰਨਾ ਕੁ ਪ੍ਰਭਾਵ ਹੈ ਇਸ ਬਾਰੇ ਜਿਵੇਂ ਗੱਲ ਕਰਾਂ ਤਾਂ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਡਾਂਸਰਾਂ ਅਤੇ ਬੋਲੀਵੁੱਡ ਦਾ ਬਹੁਤ ਜ਼ਿਆਦਾ ਪ੍ਰਭਾਵ ਹੈ ਸ਼ੋਸ਼ਲ ਮੀਡੀਆ ਨੇ ਉਸ ਨੂੰ ਹੋਰ ਵੀ ਗੂੜ੍ਹਾ ਅਤੇ ਗਹਿਰਾ ਕਰ ਦਿੱਤਾ ਜੇ ਮੈਂ ਗੱਲ ਕਰਾਂ ਤਾਂ ਡਾਂਸਰਾਂ ਦੀ ਕਿ ਲੋਕ ਸੋਸ਼ਲ ਮੀਡੀਆ 'ਤੇ ਜਿੰਨੇ ਵੀ ਡਾਂਸਰ ਹੈ ਉਹਨਾਂ ਨੂੰ ਛੋਟੇ ਛੋਟੇ ਬੱਚੇ ਬੱਚੀਆਂ ਸਭ ਫੋਲੋ ਕਰਦੇ ਆ ਅਤੇ ਉਹਨਾਂ ਦੀ ਤਰ੍ਹਾਂ ਉਹ ਡਾਂਸ ਕਰਨ ਦੀ ਕੋਸ਼ਿਸ਼ ਵੀ ਕਰਦੇ ਆ ਅਤੇ ਜੇ ਗੱਲ ਕਰਾਂ ਕਿ ਕਿਹੜੇ ਗੀਤ ਨੇ ਗੀਤ ਵੀ ਪੰਜਾਬੀ ਵੀ ਹੋ ਸਕਦੇ ਆ ਉਹ ਬੋਲੀਵੁੱਡ ਦੇ ਗੀਤ ਵੀ ਹੋ ਸਕਦੇ ਆ ਤਾਂ ਕੁੱਲ ਮਿਲਾ ਕੇ ਜੋ ਡਾਂਸਰ ਹੈ ਉਹਨਾਂ ਦਾ ਬਹੁਤ ਜ਼ਿਆਦਾ ਪ੍ਰਭਾਵ ਹੈ ਜੋ ਨਿੱਕੇ ਨਿੱਕੇ ਬੱਚੇ ਸਕੂਲ ਜਾਣ ਦੀ ਉਮਰ ਦੇ ਬੱਚੇ ਉਹਨਾਂ ਲੋਕਾਂ ਤੋਂ ਉਹਨਾਂ ਡਾਂਸਰਾਂ ਤੋਂ ਪ੍ਰਭਾਵਿਤ ਹਨ ਕਿ ਅਸੀਂ ਉਹਨਾਂ ਦੀ ਤਰ੍ਹਾਂ ਡਾਂਸ ਕਰੀਏ ਜੇ ਬੋਲੀਵੁੱਡ ਦੀ ਗੱਲ ਕਰੀਏ ਤਾਂ ਜਿੰਨੇ ਵੀ ਐਕਟਰ ਨੇ ਉਹਨਾਂ ਨੂੰ ਫੋਲੋ ਕਰਦੇ ਲੋਕ ਮੁੰਡੇ ਕੁੜੀਆਂ ਤਾਂ ਕਈ ਲੋਕ ਨੂੰ ਇਸ ਕਦਰ ਤੱਕ ਪਸੰਦ ਕਰਨ ਲੱਗ ਜਾਂਦੇ ਕਿ ਉਹ ਉਹਨਾਂ ਦੀ ਹਰ ਇੱਕ ਚੀਜ਼ ਫੋਲੋ ਕਰਦੇ ਕਿ ਉਹ ਸੁਬਹਾ ਤੋਂ ਲੈ ਕੇ ਸ਼ਾਮ ਤੱਕ ਕਿਹੜੇ ਕਿਹੜੇ ਐਕਟੀਵਿਟੀਜ਼ ਕਰਦੇ ਆ ਕੀ ਖਾਣਾ ਪਸੰਦ ਕਰਦੇ ਕਿੱਥੇ ਜਾਣਾ ਪਸੰਦ ਕਰਦੇ ਆ ਤਾਂ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਫੈਨ ਫੋਲੋਇੰਗ ਹੁੰਦੀ ਹੈ ਕਿ ਉਹ ਉਹਨਾਂ ਨੂੰ ਪੂਰੀ ਤਰ੍ਹਾਂ ਆਪਣੀ ਜ਼ਿੰਦਗੀ ਦੇ ਵਿੱਚ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਭਾਰਤ ਵਿੱਚ ਡਾਂਸਰਾਂ ਅਤੇ ਬੋਲੀਵੁੱਡ ਦਾ ਬਹੁਤ ਜ਼ਿਆਦਾ ਪ੍ਰਭਾਵ ਹੈ ਜੋ ਕਿ ਸਾਡੇ ਯੂਥ ਉੱਪਰ ਯੂਥ ਜੇ ਆਪਾਂ ਗੱਲ ਕਰੀਏ ਕਿ ਜੋਬ ਨੂੰ ਪਾਉਣ ਵਾਸਤੇ ਘੱਟ ਤਾਂ ਡਾਂਸਰਾਂ ਅਤੇ ਬੋਲੀਵੁੱਡ ਦੇ ਐਕਟਰਸ ਅਤੇ ਐਕਟਰਸ ਨੂੰ ਫੋਲੋ ਕਰਨ ਦੇ ਵਿੱਚ ਜ਼ਿਆਦਾ ਉਸਨੂੰ ਤਰਜੀਹ ਦਿੰਦੇ ਹੈ ਤਾਂ ਆਪਣੇ ਕੈਰੀਅਰ ਵੱਲ ਘੱਟ ਧਿਆਨ ਤਾਂ ਇਹਨਾਂ ਚੀਜ਼ਾਂ ਦੇ ਵਿੱਚ ਬਹੁਤ ਜ਼ਿਆਦਾ ਧਿਆਨ ਇਹਨਾਂ ਲੋਕਾਂ ਦਾ ਹੈ ਤਾਂ ਜੋ ਗੀਤ ਜ਼ਿਆਦਾ ਸੁਣੇ ਜਾਂਦੇ ਆ ਪੰਜਾਬ ਦੇ ਵਿੱਚ ਮਤਲਬ ਭਾਰਤ ਨੂੰ ਛੱਡ ਕੇ ਪੰਜਾਬ ਦੀ ਗੱਲ ਕਰਾਂ ਤਾਂ ਉਹਦੇ ਵਿੱਚ ਸਿੱਧੂ ਮੂਸੇਵਾਲਾ ਹੋ ਗਿਆ ਕਰਨ ਔਜਲਾ ਹੋ ਗਿਆ ਇਸ ਤਰ੍ਹਾਂ ਦੇ ਗਾਣੇ ਬਹੁਤ ਫੇਮਸ ਹੈ ਅਤੇ ਲੋਕ ਬਹੁਤ ਇਸ ਦੇ ਲੋਕ ਫੈਨ ਹਨ ਉਹ ਸੁਣਦੇ ਇਹਨਾਂ ਗੀਤਾ ਨੂੰ ਅਤੇ ਬੋਲੀਵੁੱਡ ਦਾ ਪ੍ਰਭਾਵ ਕਿੰਨਾ ਕੁ ਹੈ ਕਿ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਹਰੇਕ ਬੰਦਾ ਹਰ ਇੱਕ ਬੱਚਾ ਆਪਣੇ ਆਪ ਨੂੰ ਬਾਲੀਵੁੱਡ ਐਕਟਰ ਦੀ ਤਰ੍ਹਾਂ ਫੀਲ ਕਰਦਾ ਅਤੇ ਹਰ ਇੱਕ ਕੁੜੀ ਜੋ ਬੱਚੀ ਹੈ ਉਹ ਆਪਣੇ ਆਪ ਨੂੰ ਐਕਟਰਸ ਦੀ ਤਰ੍ਹਾਂ ਫੀਲ ਕਰਦੀ ਕਿ ਮੈਂ ਉਸ ਤਰ੍ਹਾਂ ਦੀ ਦਿਖਦੀ ਹਾਂ ਅਤੇ ਉਸ ਤਰ੍ਹਾਂ ਦੀ ਮੈਂ ਐਕਟੀਵਿਟੀਜ ਕਰਦੀ ਹਾਂ ਤਾਂ ਇਸ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਕਿ ਬੜਾ ਪ੍ਰਭਾਵ ਹੈ ਇਸ ਨੂੰ ਹਰ ਇੱਕ ਬੰਦਾ ਆਪਣੇ ਆਪਣੇ ਹਿਸਾਬ ਦੇ ਨਾਲ ਲਓਗਾ ਕਿ ਜੇ ਮੈਂ ਉਹਨੂੰ ਕਵਾਂ ਚੰਗਾ ਪ੍ਰਭਾਵ ਹੈ ਕਈ ਲੋਕ ਉਸਨੂੰ ਮੰਦਾ ਪ੍ਰਭਾਵ ਬੋਲਣਗੇ ਕਿਉਂਕਿ ਉਹ ਆਪਣੀ ਸਟਡੀ ਨੂੰ ਛੱਡ ਕੇ ਆਪਣੇ ਕੈਰੀਅਰ ਨੂੰ ਛੱਡ ਕੇ ਉਹਨਾਂ ਲੋਕਾਂ ਨੂੰ ਫੋਲੋ ਕਰਦੇ ਆ ਕਿ ਜਿਹਨਾਂ ਦਾ ਆਲਰੇਡੀ ਉਹ ਕੈਰੀਅਰ ਬਣਿਆ ਹੋਇਆ ਆਲਰੇਡੀ ਉਹਨਾਂ ਦਾ ਪ੍ਰੋਫੈਸ਼ਨ ਹੈ ਜੋ ਪ੍ਰੋਫੈਸ਼ਨ ਕਰ ਰਹੇ ਆ ਉਹਨਾਂ ਨੇ ਤਾਂ ਆਪਣੀ ਫਿਲਮ ਬਣਾ ਦਿੱਤੀ ਜਾਂ ਗਾਣਾ ਕੱਢਤਾ ਜਾਂ ਡਾਂਸ ਕਰ ਲਿਆ ਉਹਨਾਂ ਨੂੰ ਉਸ ਚੀਜ਼ ਦੀ ਕਮਾਈ ਮਿਲ ਜਾਣੀ ਲੇਕਿਨ ਜੋ ਸਾਡਾ ਯੂਥ ਹੈ ਉਹ ਉਹਨਾਂ ਲੋਕਾਂ ਨੂੰ ਫੋਲੋ ਕਰਕੇ ਜਾਂ ਉਹਨਾਂ ਦੇ ਗਾਣੇ ਸੁਣ ਕੇ ਜਾਂ ਉਹਨਾਂ ਦੀਆਂ ਫਿਲਮਾਂ ਦੇਖ ਕੇ ਆਪਣਾ ਟਾਈਮ ਵੇਸਟ ਕਰ ਰਿਹਾ ਕਿੱਥੇ ਤਾਂ ਜਿਹੜਾ ਟਾਈਮ ਉਹ ਉਹਨਾਂ ਨੂੰ ਪੜ੍ਹਨਾ ਚਾਹੀਦਾ ਸਟੱਡੀ ਕਰਨੀ ਚਾਹੀਦੀ ਹੈ ਆਪਣੇ ਕੈਰੀਅਰ ਵੱਲ ਧਿਆਨ ਦੇਣਾ ਚਾਹੀਦਾ ਉਸ ਸਮੇਂ ਦੇ ਵਿੱਚ ਉਹ ਉਹਨਾਂ ਡਾਂਸਰਾਂ ਨੂੰ ਉਹਨਾਂ ਬੋਲੀਵੁੱਡ ਐਕਟਰਸ ਨੂੰ ਐਕਟਰ ਨੂੰ ਫੋਲੋ ਕਰਨ ਦੇ ਵਿੱਚ ਲਗਾ ਰਿਹਾ ਆਪਣਾ ਟਾਈਮ ਵੇਸਟ ਕਰ ਰਿਹਾ ਆਪਣੇ ਕੈਰੀਅਰ ਵੇਸਟ ਕਰ ਰਿਹਾ ਬਰਬਾਦ ਕਰ ਰਿਹਾ ਕਿਉਂਕਿ ਜੋ ਸਮਾਂ ਇੱਕ ਵਾਰ ਲੰਘ ਜਾਂਦਾ ਉਹ ਦੁਬਾਰਾ ਵਾਪਸ ਨਹੀਂ ਆਉਂਦਾ ਸੋ ਇਸ ਤਰ੍ਹਾਂ ਆਪਾਂ ਕਹਿ ਸਕਦੇ ਕਿ ਪੰਜਾਬ ਜਾਂ ਭਾਰਤ ਵਿੱਚ ਗੀਤਕਾਰਾਂ ਡਾਂਸਰਾਂ ਬੋਲੀਵੁੱਡ ਐਕਟਰਾਂ ਦਾ ਬਹੁਤ ਜ਼ਿਆਦਾ ਪ੍ਰਭਾਵ ਹੈ